ਪੰਜ ਹਜ਼ਾਰ ਪੰਜ ਸੌ ਅੱਸੀ ਛੇ ਹਜ਼ਾਰ ਸੱਤ ਸੌ ਚੌਂਹਟ ਪੰਜਾਹ ਹਜ਼ਾਰ ਪੰਜ ਸੌ ਚੌਂਹਟ ਨੱਬੇ ਹਜ਼ਾਰ ਸੱਤ ਸੌ ਇਕਾਹਠ ਬਾਨ੍ਹਵੇਂ ਹਜ਼ਾਰ ਸੱਤ ਸੌ ਇਕੱਤੀ